ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਹੰਗਰੀਜ਼ ਤੋਂ ਬੋਲ ਰਹੇ ਹੋ ਸਾਨੂੰ ਨਾ ਮੈਰਿਜ ਵਾਸਤੇ ਫੰਕਸ਼ਨ ਲਈ ਅਸੀਂ ਔਡਰ ਬੁੱਕ ਕਰਨਾ ਸੀ ਸਾਨੂੰ ਕੁਝ ਕਵਾਂਟਟੀਸ ਦੇ ਵਿੱਚ ਸਮਾਨ ਚਾਹੀਦਾ ਸਾਡੇ ਦਸ ਹਜ਼ਾਰ ਬੰਦੇ ਦੀ ਗੈਦਰਿੰਗ ਹੈ ਉਹਦੇ ਲਈ ਸਾਨੂੰ ਪੰਜ ਸੌ ਕੇ ਜੀ ਸਾਨੂੰ ਗਜਰੇਲਾ ਚਾਹੀਦਾ ਹਜ਼ਾਰ ਪੀਸ ਸਾਨੂੰ ਆਈਸ ਕ੍ਰੀਮ ਚਾਹੀਦਾ ਆਈਸ ਕ੍ਰੀਮ ਦੇ ਵਿੱਚ ਸਾਨੂੰ ਪਾਈਨਐੱਪਲ ਫਲੇਵਰ ਚਾਹੀਦਾ ਚੋਕਲੇਟ ਫਲੇਵਰ ਚਾਹੀਦਾ ਅਤੇ ਵਨੀਲਾ ਫਲੇਵਰ ਚਾਹੀਦਾ ਅਤੇ ਪੰਜ ਸੌ ਕਿਲੋ ਸਾਨੂੰ ਹਲਵਾ ਮੂੰਗੀ ਦਾ ਕੜਾਹ ਜਿਹੜਾ ਉਹ ਚਾਹੀਦਾ ਪੰਜ ਸੌ ਕਿਲੋ ਗੁਲਾਬ ਜਾਮੁਨ ਚਾਹੀਦੇ ਨੇ ਤੁਸੀਂ ਉਪਲਬਧ ਹੈਗੇ ਤੁਹਾਡੇ ਕੋਲ ਤੁਸੀਂ ਕਰਵਾ ਸਕਦੇ ਹੋ ਅੱਛਾ ਜੀ ਆਈਸ ਕ੍ਰੀਮ ਸਿਰਫ ਤੁਹਾਡੇ ਕੋਲ ਤਿੰਨ ਸੌ ਹੀ ਹੈ ਚਲੋ ਠੀਕ ਹੈ ਤੁਸੀਂ ਤਿੰਨ ਸੌ ਸਾਨੂੰ ਅਰੇਂਜ ਕਰ ਦਿਉ ਬਾਕੀ ਅਸੀਂ ਕਿਤੋਂ ਹੋਰੋਂ ਲੈ ਲਵਾਂਗੇ ਅਤੇ ਗਜਰੇਲਾ ਪੰਜ ਸੌ ਕਿਲੋ ਭੇਜ ਦੇਵੋਗੇ ਅੱਛਾ ਡਰਾਈ ਫਰੂਟ ਪੈ ਕੇ ਵਿੱਚ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਹੈ ਸਾਡੇ ਫੰਕਸ਼ਨ ਦੇ ਵਿੱਚ ਕਾਫੀ ਉੱਚੇ ਮਹਿਮਾਨ ਆ ਰਹੇ ਨੇ ਇਸ ਲਈ ਕੋਈ ਵੀ ਚੀਜ਼ ਮਾਲ ਘਟੀਆ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇੰਨਾ ਸਾਰਾ ਤੁਸੀਂ ਭੇਜ ਦੇਵੋਗੇ ਸਮਾਨ ਹਲਵਾ ਮੂੰਗੀ ਦਾ ਪੰਜ ਸੌ ਕਿਲੋ ਆ ਜਾਵੇਗਾ ਚਲੋ ਤਿੰਨ ਸੌ ਤਿੰਨ ਸੌ ਤੁਸੀਂ ਚਲੋ ਕੋਈ ਗੱਲ ਨਹੀਂ ਤੁਸੀਂ ਤਿੰਨ ਸੌ ਅਰੇਂਜ ਕਰ ਦਿਓ ਦੋ ਸੌ ਅਸੀਂ ਕਿਤੋਂ ਹੋਰੋਂ ਕਰ ਲਵਾਂਗੇ ਠੀਕ ਹੈ ਜੀ ਓਕੇ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਜੇਰੀਆ ਤੋਂ ਬੋਲ ਰਹੇ ਹੋ ਹਾਂਜੀ ਸਾਡੇ ਨਾ ਘਰ ਵਿੱਚ ਫੰਕਸ਼ਨ ਹੈ ਅਤੇ ਉਹਦੇ ਲਈ ਸਾਨੂੰ ਕੁਝ ਡਿਸ਼ਿਸ਼ ਅਸੀਂ ਸਵੀਟ ਡਿਸ਼ਿਜ਼ ਔਡਰ ਕਰਨੀਆਂ ਸੀ ਤੁਸੀਂ ਕਰ ਸਕਦੇ ਹੋ ਹਾਂਜੀ ਸਾਨੂੰ ਚਾਹੀਦਾ ਹੈ ਪੰਜ ਸੌ ਕਿਲੋ ਗਜਰੇਜਾ ਗਜਰੇਲਾ ਅਤੇ ਸਾਨੂੰ ਚਾਹੀਦੇ ਹੈ ਅੱਠ ਸੌ ਪੀਸ ਸਾਨੂੰ ਚਾਹੀਦੇ ਹੈ ਆਈਸ ਕ੍ਰੀਮ ਦੇ ਜਿਹਦੇ ਵਿੱਚੋਂ ਪਾਈਨਐਪਲ ਫਲੇਵਰ ਚੋਕਲੇਟ ਫਲੇਵਰ ਅਤੇ ਵਨੀਲਾ ਫਲੇਵਰ ਤਿੰਨ ਸਾਨੂੰ ਫਲੇਵਰ ਚਾਹੀਦੇ ਅਤੇ ਪੰਜ ਸੌ ਕਿਲੋ ਸਾਨੂੰ ਮੂੰਗੀ ਦਾ ਕੜਾਹ ਚਾਹੀਦਾ ਅਤੇ ਪੰਜ ਸੌ ਕਿਲੋ ਹੀ ਸਾਨੂੰ ਗੁਲਾਬ ਜਾਮੁਨ ਚਾਹੀਦੇ ਨੇ ਤੁਸੀਂ ਕਰ ਦੇਵੋਗੇ ਅਵੇਲੇਬਲ ਠੀਕ ਹੈ ਜੀ ਪੰਜ ਸੌ ਨਹੀਂ ਕਰ ਸਕਦੇ ਤਿੰਨ ਸੌ ਕਰ ਦੇਵੋਗੇ ਚਲੋ ਕੋਈ ਗੱਲ ਨਹੀਂ ਤੁਸੀਂ ਤਿੰਨ ਸੌ ਭੇਜ ਦੇਣਾ ਅੱਛੀ ਕੁਆਲਿਟੀ ਦਾ ਹਰ ਇੱਕ ਚੀਜ਼ ਵਧੀਆ ਪਾ ਕੇ ਠੀਕ ਹੈ ਕਿਉਂਕਿ ਸਾਡੇ ਮਹਿਮਾਨ ਬੜੇ ਉੱਚ ਕੋਟੀ ਦੇ ਆ ਰਹੇ ਨੇ ਇਸ ਲਈ ਕੋਈ ਵੀ ਚੀਜ਼ ਵਧੀਆ ਹੋਣੀ ਚਾਹੀਦੀ ਹੈ ਕੋਈ ਚੀਜ਼ ਘਟੀਆ ਨਾ ਹੋਵੇ ਚਲੋ ਠੀਕ ਹੈ ਤੁਸੀਂ ਟਾਈਮ 'ਤੇ ਸਾਨੂੰ ਔਡਰ ਪਹੁੰਚਾ ਦਿਉ ਬਾਕੀ ਅਸੀਂ ਹੋਰ ਕਿਤੋਂ ਅਰੇਂਜ ਕਰ ਲਵਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਰਦਰ ਢਾਬੇ ਤੋਂ ਬੋਲ ਰਹੇ ਹੋ ਹਾਂਜੀ ਸਾਡੇ ਨਾ ਘਰ ਵਿੱਚ ਪ੍ਰੋਗਰਾਮ ਸੀ ਇੱਕ ਅਤੇ ਅਸੀਂ ਉਹਦੇ ਲਈ ਸਾਨੂੰ ਕੁਝ ਮਿੱਠੇ ਦੀਆਂ ਕੁਝ ਡਿਸ਼ਿਜ਼ ਚਾਹੀਦੀਆਂ ਸੀ ਅਤੇ ਸਾਡਾ ਥੋੜ੍ਹਾ ਬਹੁਤ ਅਰੇਂਜ ਹੋ ਗਿਆ ਅਤੇ ਥੋੜ੍ਹਾ ਬਹੁਤ ਤੁਹਾਡੇ ਕੋਲੋਂ ਕਰਵਾਉਂਦੇ ਹਾਂ ਤੁਹਾਡੇ ਕੋਲੋਂ ਗਜਰੇਲਾ ਮਿਲ ਜਾਵੇਗਾ ਸਰ ਸਾਨੂੰ ਪੰਜ ਸੌ ਕਿਲੋ ਗਰੇ ਗਜਰੇਲਾ ਚਾਹੀਦਾ ਸਾਡੇ ਦਸ ਹਜ਼ਾਰ ਬੰਦੇ ਦੀ ਗੈਦਰਿੰਗ ਹੈ ਸਾਨੂੰ ਪੰਜ ਸੌ ਕਿਲੋ ਗਜਰੇਲਾ ਚਾਹੀਦਾ ਅਤੇ ਆਈਸ ਕ੍ਰੀਮ ਚਾਹੀਦੀ ਸਾਨੂੰ ਤਿੰਨ ਸੌ ਉਹਦੇ 'ਚ ਸਾਨੂੰ ਪਾਈਨਐਪਲ ਫਲੇਵਰ ਚਾਹੀਦਾ ਚੋਕਲੇਟ ਫਲੇਵਰ ਅਤੇ ਵਨੀਲਾ ਫਲੇਵਰ ਅਤੇ ਸਾਨੂੰ ਮੂੰਗੀ ਦਾ ਕੜਾਹ ਵੀ ਚਾਹੀਦਾ ਪੰਜ ਸੌ ਕਿਲੋ ਚਲੋ ਠੀਕ ਹੈ ਦੋ ਸੌ ਕਿਲੋ ਅਵੇਲੇਬਲ ਹੈ ਤੁਸੀਂ ਦੋ ਸੌ ਭੇਜ ਦੇਣਾ ਅਤੇ ਗੁਲਾਬ ਜਾਮੁਨ ਮਿਲ ਜਾਣਗੇ ਪੰਜ ਸੌ ਕਿਲੋ ਸਾਨੂੰ ਗੁਲਾਬ ਜਾਮੁਨ ਵੀ ਚਾਹੀਦੇ ਨੇ ਪਰ ਅੱਛੀ ਕੁਆਲਿਟੀ ਦਾ ਮਾਲ ਹੋਏ ਕੋਈ ਵੀ ਚੀਜ਼ ਖਰਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕਾਫੀ ਅੱਛੇ ਗੈਸਟ ਆ ਰਹੇ ਨੇ ਅਤੇ ਕੋਈ ਵੀ ਚੀਜ਼ ਦੇ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ ਵਧੀਆ ਤੋਂ ਵਧੀਆ ਕੁਆਲਿਟੀ ਦੀ ਚੀਜ਼ ਹੋਣੀ ਚਾਹੀਦੀ ਹੈ ਤੁਸੀਂ ਭੇਜ ਦੇਵੋਗੇ ਟਾਈਮ 'ਤੇ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ